ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਮੈਮ ਤੁਸੀਂ ਮਠਿਆਈ ਵਾਲੀ ਦੁਕਾਨ ਤੋਂ ਬੋਲਦੇ ਹੋ ਹਾਂਜੀ ਅਸੀਂ ਮਠਿਆਈ ਬਣਵਾਉਣੀ ਸੀਗੀ ਇੱਕ ਭੁੱਗਾ ਦੀ ਅਤੇ ਇੱਕ ਖਜੂਰਾਂ ਦੀ ਸਾਡੇ ਲੋਹੜੀ ਦਾ ਫੰਕਸ਼ਨ ਹੈ ਸਾਨੂੰ ਪੰਜਾਹ ਕਿਲੋ ਮਠਿਆਈ ਚਾਹੀਦੀ ਹੈ ਹਾਂਜੀ ਸਾਫ਼ ਸੁਥਰੀ ਹੋਣੀ ਚਾਹੀਦੀ ਹੈ ਕੀ ਪ੍ਰਾਈਜ਼ ਕੀ ਹੈ ਕੀ ਰੇਟ ਹੈ ਹਾਂਜੀ ਚਲੋ ਰੇਟ ਦੀ ਤਾਂ ਕਿਵੇਂ ਬਣਾਓਗੇ ਕੀ ਖੋਆ ਕਿੰਨਾ ਹੋਵੇਗਾ ਵਿੱਚ ਹਾਂਜੀ ਹਾਂਜੀ ਹਾਂਜੀ ਨਹੀਂ ਤੁਸੀਂ ਗੁੜ ਹੀ ਪਾਇਆ ਜੇ ਚਲੋ ਮਤਲਬ ਠੀਕ ਠੀਕ ਹੋਵੇ ਜ਼ਿਆਦਾ ਤੇਜ਼ ਵੀ ਨਾ ਹੋਵੇ ਹਾਂਜੀ ਖਜੂਰਾਂ ਦੇ ਵਿੱਚ ਵੀ ਮਿੱਠਾ ਹੀ ਪਾਇਓ ਉਹਦੇ ਵਿੱਚ ਤਾਂ ਘੱਟ ਪਾਇਓ ਹਾਂਜੀ ਹਾਂਜੀ ਪੰਜਾਹ ਡੱਬੇ ਤੁਸੀਂ ਤਿਆਰ ਕਰਨੇ ਆ ਇੱਕ ਡੱਬਾ ਕਿੰਨੇ ਦਾ ਲੱਗੇਗਾ ਫਿਰ ਵੀ ਠੀਕ ਹੈ ਜੀ ਹਾਂਜੀ ਹਾਂਜੀ ਹਾਂ ਨਹੀਂ ਉਹ ਤਾਂ ਸਹੀ ਹੈ ਤੁਹਾਡੀ ਗੱਲ ਹਾਂਜੀ ਬਸ ਸਾਫ਼ ਸੁਥਰਾ ਹੋਵੇ ਹਾਂਜੀ ਅਤੇ ਲੋਹੜੀ ਤੋਂ ਤੁਸੀਂ ਦੋ ਤਿੰਨ ਦਿਨ ਪਹਿਲਾਂ ਮਤਲਬ ਦੋ ਤਿੰਨ ਦਿਨ ਪਹਿਲਾਂ ਤਿਆਰ ਰੱਖਿਓ ਲੋਹੜੀ ਤੋਂ ਹਾਂਜੀ ਬਾਕੀ ਸਫਾਈ ਤਾਂ ਤੁਸੀਂ ਧਿਆਨ ਰੱਖਣਾ ਹੈ ਬਾਕੀ ਡੱਬੇ ਵੀ ਤੁਸੀਂ ਐਨ ਵਧੀਆ ਮਤਲਬ ਤਿਆਰ ਕਰਨੇ ਆ ਹਾਂਜੀ ਹਾਂਜੀ ਹਾਂਜੀ ਅਸੀਂ ਤੁਹਾਡੀ ਸ਼ੌਪ ਦਾ ਬਹੁਤ ਨਾਮ ਸੁਣਿਆ ਤਾਂ ਹੀ ਅਸੀਂ ਤੁਹਾਨੂੰ ਪਹਿਲ ਦਿੱਤੀ ਹੈ ਹਾਂਜੀ ਹਾਂਜੀ ਉਹਦੀ ਸਜਾਵਟ ਵਧੀਆ ਕਰ ਦਿਓ ਪੈਕਿੰਗ ਵ ਹਾਂਜੀ ਪੈਕਿੰਗ ਵਧੀਆ ਕਰ ਦਿਓ ਹਾਂਜੀ ਚਲੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਫਿਰ ਲੋਹੜੀ ਤੋਂ ਦੋ ਤਿੰਨ ਦਿਨ ਪਹਿਲਾਂ ਆਪੇ ਕੋਲ ਕਰ ਦਿਓ ਜਦੋਂ ਰੈਡੀ ਹੋ ਗਏ ਹਾਂਜੀ ਠੀਕ ਹੈ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ